ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ ਇਸ ਕਰਕੇ ਇਸਨੇ ਸਾਨੂੰ ਸੱਭਿਆਚਕ ਤੌਰ 'ਤੇ ਅਲੱਗ ਪਛਾਣ ਬਣਾਈ ਹੈ ਪੰਜਾਬ ਦੇ ਲੋਕਾਂ ਦੀ ਬੋਲੀ ਅਤੇ ਸਿੱਖ ਧਰਮ ਕਰਕੇ ਅਸੀਂ ਸੱਭਿਆਚਕ ਤੌਰ 'ਤੇ ਸਾਰੇ ਭਾਰਤ ਨਾਲੋਂ ਅਲੱਗ ਦਿਖਦੇ ਹਾਂ ਅਤੇ ਸਿੱਖ ਧਰਮ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ ਸਿਰਫ਼ ਤਿੰਨ ਚਾਰ ਸੌ ਸਾਲ ਪੁਰਾਣਾ ਹੈ ਇਸ ਵਿੱਚ ਬਹੁਤ ਮਹਾਨ ਯੋਧੇ ਹੋਏ ਹਨ ਜਿੰਨ੍ਹਾਂ ਵਿੱਚੋ ਸਭ ਤੋਂ ਜ਼ਿਆਦਾ ਨਾਮ ਸੰਸਾਰ ਵਿੱਚ ਮਹਾਜਾ ਮਹਾਰਾਜਾ ਰਣਜੀਤ ਸਿੰਘ ਦਾ ਮਸ਼ਹੂਰ ਹੈ ਜਿੰਨ੍ਹਾਂ ਨੇ ਅਲੱਗ ਅਲੱਗ ਮਿਸਲਾਂ ਨੂੰ ਇਕੱਠਿਆਂ ਕਰਕੇ ਸਿੱਖ ਧਰਮ ਅਤੇ ਖਾਲਸਾ ਰਾਜ ਬਣਾਇਆ ਜਿਸ ਕਰਕੇ ਅਸੀਂ ਅੱਜ ਵੀ ਸੰਸਾਰ ਭਰ ਵਿੱਚ ਖਾਲਸਾ ਰਾਜ ਦੀ ਗੱਲ ਕਰਨ ਦੇ ਕਾਬਿਲ ਹਾਂ ਅਤੇ ਉਹਨਾਂ ਦੀ ਮਹਾਂ ਸ਼ਖਸ਼ੀਅਤ ਦੂਰ ਅੰਦੇਸੀ ਸੋਚ 'ਤੇ ਸਾਨੂੰ ਬਹੁਤ ਜ਼ਿਆਦਾ ਮਾਣ ਹੈ ਅਸੀਂ ਅੱਜ ਵੀ ਉਹਨਾਂ ਦੀਆਂ ਨੇਕੀਆਂ ਉਹਨਾਂ ਦੁਆਰਾ ਕੀਤੇ ਹੋਏ ਉੱਦਮ ਕਾਰਜਾਂ ਨੂੰ ਯਾਦ ਕਰਦੇ ਹਾਂ ਉਹਨਾਂ ਉੱਤੇ ਮਾਣ ਮਹਿਸੂਸ ਕਰਦੇ ਹਾਂ